ਹਾਂ ਮੈਂ ਵੋਆਈਸ ਕੋਲਾਂ ਅਤੇ ਵੀਡੀਓ ਕੋਲਾਂ ਨੂੰ ਤਰਜੀਹ ਦਿੰਦਾ ਹਾਂ ਕਿਉਂਕਿ ਪਹਿਲਾਂ ਵਾਲੇ ਸਮੇਂ ਵਿੱਚ ਜਾ ਵੀਡੀਓ ਕੋਲ ਜਾਂ ਵੋਆਇਸ ਕੋਲ ਨਹੀਂ ਹੁੰਦੀ ਸੀ ਅਤੇ ਫੋਨ ਲੈਂਡਲਾਈਨ ਫੋਨ ਕਿਸੇ ਕਿਸੇ ਕੋਲ ਹੁੰਦੇ ਸੀ ਇਸ ਲਈ ਜ਼ਿਆਦਾਤਰ ਲੋਕ ਖੱਤ ਪਾਉਂਦੇ ਸਨ ਇਸ ਨਾਲ ਕੀ ਜੋ ਵੀ ਖ਼ਬਰ ਸੀ ਉਹ ਸਾਨੂੰ ਲੇਟ ਮਿਲਦੀ ਸੀ ਕਿਉਂਕਿ ਖੱਤ ਆਉਣ ਨੂੰ ਟਾਈਮ ਲੱਗ ਜਾਂਦਾ ਸੀ ਕਈ ਵਾਰ ਦਸ ਦਿਨ ਜਾਂ ਪੰਦਰ੍ਹਾਂ ਦਿਨ ਵੀ ਲੱਗ ਜਾਂਦੇ ਸਨ ਬ ਸਾਨੂੰ ਪਰ ਹੁਣ ਕਾਲ ਆਉਣ ਕਾਰ ਫੋਨ ਹੋਣ ਕਾਰਨ ਸਾਨੂੰ ਖ਼ਬਰ ਬਾਰੇ ਜਦੀ ਪਤਾ ਲੱਗ ਜਾਂਦਾ ਹੈ ਇਸ ਲਈ ਫੋਨ ਮਹੱਤਵਪੂਰਨ ਹਿੱਸਾ ਨਿਭਾਉਂਦੇ ਹਨ ਮੈਂ ਵੈਸੇ ਤਾਂ ਜ਼ਿਆਦਾ ਫੋਨ ਨਹੀਂ ਵਰਤਦਾ ਪਰ ਫਰੀ ਸਮੇਂ ਮੈਂ ਫੋਨ ਨੂੰ ਵਰਤਦਾ ਹਾਂ